ਸਾਨੂੰ ਆਪਣੇ ਬੱਚਿਆਂ ਨੂੰ ਇਤਿਹਾਸ ਪੜ੍ਹਾਉਣਾ ਬਹੁਤ ਜ਼ਰੂਰੀ ਹੈ ਵੀ ਤਾਂ ਜੋ ਉਨ੍ਹਾਂ ਨੂੰ ਪਿਛਲੇ ਸਮਿਆਂ ਵਿੱਚ ਜੋ ਵੀ ਕੁਛ ਹੋਇਆ ਹੈ ਤਾਂ ਜੋ ਉਨ੍ਹਾਂ ਨੂੰ ਪਤਾ ਲੱਗ ਸਕੇ ਕਿ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ ਉਨ੍ਹਾਂ ਨੂੰ ਇਤਿਹਾਸ ਪਤਾ ਹੋਣ ਕਾਰਨ ਵੀ ਉਹ ਇਸ ਮੁੱਢਲੇ ਜੀਵਨ ਨੂੰ ਪੁਰਾਣੇ ਜੀਵਨ ਨਾਲ ਕੰਪੇਅਰ ਕਰ ਸਕਦੇ ਹਾਂ ਇਹ ਇਤਿਹਾਸ ਨਾਲ ਉਨ੍ਹਾਂ ਨੂੰ ਸਾਡੇ ਗੁਰੂਆਂ ਪੀਰਾਂ ਜਾਂ ਉਨ੍ਹਾਂ ਦੀਆਂ ਜੋ ਪ੍ਰਾਪਤੀਆਂ ਤਾਂ ਕਿ ਉਨ੍ਹਾਂ ਨੂੰ ਪਤਾ ਲੱਗ ਸਕੇ ਵੀ ਇਹਨਾਂ ਨੇ ਜੋ ਵੀ ਗੁਰੂ ਪੀਰਾਂ ਨੇ ਪ੍ਰਾਪਤੀਆਂ ਜਾਂ ਜੋ ਸੰਦੇਸ਼ ਲੋਕਾਂ ਨੂੰ ਦਿੱਤਾ ਹੈ ਉਸ ਬਾਰੇ ਵੀ ਜਾਗਰੂਕ ਹੋ ਜਾਣ ਤਾਂ ਜੋ ਕੋਈ ਅੱਗੇ ਸਮਾਜ ਵਿੱਚ ਕੋਈ ਉਨ੍ਹਾਂ ਨੂੰ ਕੁਓਸਚਨ ਪੁੱਟ ਕਰੇ ਤਾਂ ਵੀ ਉਹ ਜੇ ਇਤਿਹਾਸ ਉਨ੍ਹਾਂ ਨੂੰ ਪਤਾ ਹੋਵੇ ਤਾਂ ਉਹ ਵੀ ਕੁਓਚਨ ਦੇ ਉਨ੍ਹਾਂ ਨੂੰ ਜਵਾਬ ਦੇ ਸਕੇ